ਹੈਲੋ ਹਾਂਜੀ ਜੀ ਨਮਸਤੇ ਵੀਰ ਜੀ ਠੀਕ ਹੈ ਬੱਚੇ ਵੀ ਠੀਕ ਹੈ ਤੁਸੀਂ ਸੁਣਾਓ ਆਪਣੇ ਬੱਚਿਆਂ ਦਾ ਗੁੜੀਆ ਦਾ ਬਸ ਠੀਕ ਠਾਕ ਹਾਂ ਲੱਗੇ ਵੇ ਨੇ ਬੇਟੇ ਨੇ ਤਾਂ ਗ੍ਰੈਜੂਏਸ਼ਨ ਕਰ ਲਈ ਹੈ ਕੁਛ ਵੀ ਨਹੀਂ ਅਜੇ ਇਸ ਤਰ੍ਹਾਂ ਹੀ ਆ ਭਰੇ ਵੇ ਆ ਫਾਰਮ

ਦੇਖੋ ਹੁਣ ਅੱਗੇ ਕੀ ਬਣਦਾ ਮਿਲਦੀ ਨੌਕਰੀ ਜਾਂ ਨਹੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਠੀਕ ਆ ਔਰ ਗੁੜੀਆ ਕੀ ਕਰਦੀ ਆ ਹਾਂਜੀ ਹਾਂਜੀ ਹਾਂਜੀ ਹਾਂ ਠੀਕ ਹੈ ਹਾਂਜੀ ਬਾਹਰ ਹੀ ਫਿਰਦੇ ਰਹਿੰਦੇ ਨਾ ਆ ਹੋਰ ਹਾਂਜੀ ਵਾ ਠੀਕ ਆ ਹੁਣ ਸਭ ਹਾਂਜੀ ਸਮਝਾਉਣਾ ਵੀ ਕਿੰਨਾ ਕੁ ਹੁੰਦਾ ਮੰਨਦੇ ਨਹੀਂ ਹਾਂਜੀ ਹਾਂਜੀ ਵਾ ਠੀਕ ਹੈ ਚਲ ਠੀਕ ਹੈ